ਭਾਰਤ ਦੇ ਡਾਂਸਰਾਂ ਦੇ ਉੱਪਰ ਬਾਲੀਵੁੱਡ ਦਾ ਕਾਫ਼ੀ ਪ੍ਰਭਾਵ ਹੈ ਅਤੇ ਜੋ ਬਾਲੀਵੁੱਡ ਦੇ ਸਿੰਗਰ ਉਹਨਾਂ ਨੂੰ ਗਾਉਂਦੇ ਹਨ ਉਹਨਾਂ ਦੇ ਭ ਭਾਰਤ ਦੇ ਹਰ ਨਾਗਰਿਕ ਦੇ ਉੱਪਰ ਉਹਨਾਂ ਦਾ ਪ੍ਰਭਾਵ ਪੈਂਦਾ ਹੈ ਅਤੇ ਜ਼ਿਆਦਾ ਜਿਹੜੇ ਪਸੰਦ ਕੀਤੀ ਜਾਂਦੇ ਹਨ ਉਹਨਾਂ ਵਿੱਚ ਦੇਸ਼ ਭਗਤੀ ਦੇ ਗੀਤ ਹਨ ਜਿਹਨਾਂ ਨੂੰ ਭਾਰਤ ਦਾ ਹਰ ਵਸ਼ਿੰਦਾ ਇੱਥੋਂ ਦਾ ਰਹਿਣ ਵਾਲਾ ਅ ਆਪਣੇ ਜੀਵਨ ਦੇ ਵਿੱਚ ਢਾਲ ਲੈਂਦਾ ਹੈ ਅਤੇ ਉਹਨਾਂ ਦੀਆਂ ਧੁਨਾਂ ਦੇ ਉੱਤੇ ਜਦੋਂ ਉਹ ਗੀਤ ਵੱਜਦੇ ਹਨ ਨੱਚਣ ਲੱਗ ਪੈਂਦੇ ਹਨ ਅਤੇ ਇਸ ਦੀ ਜੇ ਮਿਸਾਲ ਦੇਖਣੀ ਹੋਵੇ ਤਾਂ ਸਾਨੂੰ ਵਾਹਗਾ ਬਾਡਰ ਦੇ ਉੱਪਰ ਜਦੋਂ ਸੈਰੇਮਨੀ ਹੁੰਦੀ ਹੈ ਸ਼ਾਮ ਨੂੰ ਝੰਡਾ ਲਾਹੁਣ ਦੀ ਤਾਂ ਉਦੋਂ ਉੱਥੇ ਲੋਕ ਜੋ ਸ਼ਾਮਿਲ ਹੁੰਦੇ ਆ ਅਤੇ ਇਹਨਾਂ ਗੀਤਾਂ ਦੇ ਉੱਪਰ ਨੱਚਦੇ ਅਸੀਂ ਉਹਨਾਂ ਨੂੰ ਦੇਖ ਸਕਦੇ ਹਾਂ ਅਤੇ ਉਹ ਬੋਲੀਵੁੱਡ ਦੇ ਵਿੱਚ ਜੋ ਪੁਰਾਣੀਆਂ ਫਿਲਮਾਂ 'ਚ ਜਾਂ ਬਾਡਰ ਵਰਗੀ ਫਿਲਮਾਂ ਦੇ ਵਿੱਚ ਜੋ ਗੀਤ ਆਏ ਉਹਨਾਂ ਨੇ ਉਹ ਵਜਾਉਂਦੇ ਹਨ ਅਤੇ ਉਹਨਾਂ ਦੇ ਉੱਪਰ ਨਾਚ ਕਰਦੇ ਹਨ ਅਤੇ ਇ ਇਸ ਤਰੀਕੇ ਨਾਲ ਬੋਲੀਵੁੱਡ ਦਾ ਦੇ ਡਾਂਸ ਦਾ ਭਾਰਤ ਦੇ ਲੋਕਾਂ ਉੱਤੇ ਕਾਫ਼ੀ ਪ੍ਰਭਾਵ ਦੇਖਣ ਨੂੰ ਮਿਲਦਾ ਹੈ